ਜਦੋਂ ਜਦੋਂ ਸਵੇਰੇ ਡੰਗਰਾਂ ਨੂੰ ਕੱਖ ਪਾਉਣ ਜਾਂਦੇ ਹਾਂ ਪਹਿਲਾਂ ਸਾਰਿਆਂ ਨਾਲੋਂ ਗੋਹਾ ਇਕੱਠਾ ਕ ਕਰਿਆ ਜਾਂਦਾ ਹੈ ਗੋਹਾ ਇਕੱਠਾ ਕਰਨ ਤੋਂ ਬਾਅਦ ਸਿੰਬਰਦੇ ਹਾਂ ਸਵਾਰ ਕੇ ਅਤੇ ਉਹਨਾਂ ਨੂੰ ਜੋ ਗੋਹਾ ਹੈ ਉਹਨੂੰ ਟੋਕਰੇ ਵਿੱਚ ਪਾ ਕੇ ਰੂੜੀ 'ਤੇ ਸਿੱਟ ਦਿੱਤਾ ਜਾਂਦਾ ਹੈ ਅਤੇ ਉਹਨੂੰ ਜਦੋਂ ਆਪਾਂ ਨੇ ਰੇਹ ਦੀ ਤਰ੍ਹਾਂ ਵਰਤਣਾ ਹੈ ਅਤੇ ਛੇ ਮਹੀਨੇ ਉਹਨੂੰ ਰੂੜੀ ਅਤੇ ਪਿਆ ਰਹਿਣ ਦਿੰਦੇ ਆ ਵੀ ਰੇਹ ਬਣ ਜਾਵੇ ਫਿਰ ਉਹਨੂੰ ਫਸਲਬਾੜੀ ਵਿੱਚ ਖੇਤਾਂ ਵਿੱਚ ਪਾ ਦਿੱਤਾ ਜਾਂਦਾ ਹੈ ਕਿ ਫਸਲ ਨੂੰ ਚੰਗੀ ਤਰ੍ਹਾਂ ਲੱਗ ਜਾਵੇ ਇਹ ਜਿਹੜਾ ਕੁਦਰਤੀ ਰੇਹ ਹੈ ਇਹ ਫਸਲਬਾੜੀ ਵਾਸਤੇ ਚੰਗਾ ਹੈ